ਪੰਜਾਬ ਵਿੱਚ ਰੁੱਤਾਂ ਸਮੇਂ ਸਮੇਂ ਨਾਲ਼ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਕਿ ਸਰਦੀ ਗਰਮੀ ਬਸੰਤ ਬਰਸਾਤ ਪੱਤਝੜ ਆਦਿ ਪਰ ਮੈਨੂੰ ਇਨ੍ਹਾਂ ਰੁੱਤਾਂ ਵਿੱਚੋਂ ਸਭ ਤੋਂ ਜ਼ਿਆਦਾ ਗਰਮੀ ਦੀ ਰੁੱਤ ਬਹੁਤ ਪਸੰਦ ਹੈ ਕਿਉਂਕਿ ਗਰਮੀਆਂ ਵਿੱਚ ਦਿਨ ਵੱਡੇ ਹੁੰਦੇ ਹਨ ਕੰਮ ਕਾਰ ਲਈ ਬਹੁਤ ਸਮਾਂ ਮਿਲ ਜਾਂਦਾ ਹੈ ਗਰਮੀਆਂ ਵਿੱਚ ਘੁੰਮਣ ਲਈ ਵੀ ਅਸੀਂ ਪਹਾੜੀ ਖੇਤਰਾਂ ਵਿੱਚ ਜਾ ਜਾ ਜਾ ਸਕਦੇ ਹਾਂ ਅਤੇ ਗਰਮੀਆਂ ਵਿੱਚ ਫਲ਼ ਵੀ ਬਹੁਤ ਤਰ੍ਹਾਂ ਦੇ ਆਉਂਦੇ ਹਨ ਜੋ ਮੈਨੂੰ ਬਹੁਤ ਪਸੰਦ ਹਨ ਇਹਨਾਂ ਸਭ ਗੱਲਾਂ ਕਰਕੇ ਮੈਨੂੰ ਗਰਮੀਆਂ ਦਾ ਮੌਸਮ ਬਹੁਤ ਪਸੰਦ ਹੈ